ਮੈਂ ਆਈਟੀ ਵਿਭਾਗ ਵਿੱਚ ਕੰਮ ਕਰਦੀ ਆਂ ਤੇ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਮੇਰਾ ਡਿਜੀਟਲ ਲੌਕਰ ਬਦਲਿਆ ਜਾਵੇ ਇਹ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕੀ ਮੈਨੂੰ ਕਿਹੜੇ ਕਿਹੜੇ ਡਾਕੂਮੈਂਟ ਦੀ ਲੋੜ ਪਵੇਗੀ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਸਰਟੀਫਿਕੇਟ ਫੋਟੋ ਕਾਪੀ ਇਸ ਤਰਾਂ ਮੈਨੂੰ ਦੱਸਿਆ ਜਾਵੇ ਇਹ ਮੇਰਾ ਡਿਜੀਕਲ ਲੋਕਰ ਚੇਂਜ ਕੀਤਾ ਜਾਵੇ